ਸਰ ਮੈਂ ਨਾ ਇੱਕ ਕੈਬ ਬੁੱਕ ਕਰਨਾ ਚਾਹੁੰਦਾ ਹਾਂ ਜਿਹਦੇ ਵਿੱਚ ਮੈਨੂੰ ਕੋਈ ਮਤਲਬ ਕਿ ਛੂਟ ਮਿਲ ਜਾਵੇ ਅਤੇ ਮੈਂ ਨਾ ਅੰਮ੍ਰਿਤਸਰ ਤੋਂ ਆਪਣੇ ਘਰ ਤੋਂ ਰੇਲਵੇ ਸਟੇਸ਼ਨ ਲਈ ਕੈਬ ਬੁੱਕ ਕਰਨਾ ਚਾਹੁੰਦਾ ਸਰ ਮੈਨੂੰ ਇੱਕ ਪ੍ਰੋਮੋ ਕੋਡ ਆ ਰਿਹਾ ਕਿਆ ਮੈਨੂੰ ਉਹਦੇ ਵਿੱਚ ਛੂਟ ਮਿਲ ਜਾਵੇਗੀ ਜੇ ਤਾਂ ਛੂਟ ਮਿਲ ਜਾਵੇਗੀ ਤਾਂ ਮੈਂ ਬ ਕੈਬ ਬੁੱਕ ਕਰਦਾ ਹਾਂ ਹਾਂ ਜੀ ਤੁਹਾਨੂੰ ਛੂਟ ਮਿਲ ਜਾਣੀ ਹੈ ਤਾਂ ਮੈਨੂੰ ਤੁਸੀਂ ਇਸ ਤਰ੍ਹਾਂ ਕਰੋ ਮੇਰੀ ਸਵੇਰੇ ਪੰਜ ਵਜੇ ਦੀ ਟ੍ਰੇਨ ਹੈ ਉਹਦੇ ਵਿਚ ਮੇਰੀ ਤੁਸੀਂ ਕੈਬ ਬੁੱਕ ਕਰ ਲਓ ਸਵੇਰੇ ਸਾਢੇ ਚਾਰ ਵਜੇ ਦੀ ਔਰ ਸਟੇਸ਼ਨ ਦੀ ਜੇ ਮੈਨੂੰ ਛੂਟ ਮਿਲ ਰਹੀ ਹੈ ਤਾਂ ਤੁਸੀਂ ਮੈਨੂੰ ਕਿੰਨੀ ਛੂਟ ਦਿਓਗੇ ਤਾਂ ਕੈਬ ਬੁੱਕ ਕਰ ਲਓ ਔਰ ਮੈਂ ਕੈਬ ਬੁੱਕ ਕਰਾ ਲਈ ਔਰ ਕੈਬ ਦੇ ਵਿੱਚ ਮੈਂ ਗਿਆ ਕੈਬ ਵਾਲਿਆਂ ਨੇ ਗੱਲਾਂ ਕੀਤੀਆਂ ਕਿ ਅਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਵਾਰੀਆਂ ਚੁੱਕਦੇ ਹਨ ਕੀ ਕਰਦੇ ਹਾਂ ਅਤੇ ਕਿਸ ਤਰ੍ਹਾਂ ਕਰਦੇ ਹਾਂ